ਵਾਹਿਗੁਰੂ ਜੀ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੋ ਸਾਡੇ ਗੁਰੂਆਂ ਨੇ ਬਾਣੀ ਰਚ ਕੇ ਅਧਿਆਤਮਿਕ ਤੌਰ 'ਤੇ ਅਧਿਆਪਕ ਬਣਾਇਆ ਹੈ ਉਹ ਗੁਰੂ ਗ੍ਰੰਥ ਸਾਹਿਬ ਹਨ ਜਿਹਦੇ ਨਾਲ ਸਾਨੂੰ ਸਾਰੀ ਸੇਧ ਮਿਲਦੀ ਹੈ ਜਨਮ ਤੋਂ ਲੱਗ ਕੇ ਮਰਨ ਤੱਕ ਅਸੀਂ ਗੁਰਬਾਣੀ ਜਿਹੜੀ ਹਰ ਵਕਤ ਪੜ੍ਹਦੇ ਹਾਂ ਅਤੇ ਜਿਨ੍ਹਾਂ ਨਾਲ ਸਾਨੂੰ ਹਰ ਕਾਰੋਬਾਰ ਦੇ ਵਿੱਚ ਕੁਛ ਕੋਈ ਵੀ ਕੰਮ ਕਰਨਾ ਹੋਏ ਅਸੀਂ ਗੁਰਬਾਣੀ ਨੂੰ ਪਹਿਲਾਂ ਰੱਖਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਕੇ ਉਹਦਾ ਭੋਗ ਪੁਆ ਕੇ ਜੋ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਸਾਨੂੰ ਮਿਲਦਾ ਹੈ ਉਹ ਸਾਨੂੰ ਸਾਰੀ ਸ਼ਕਤੀ ਪ੍ਰਦਾਨ ਕਰਦਾ ਹੈ ਹਰ ਦੁੱਖ ਸੁੱਖ ਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਯਾਦ ਕਰਦੇ ਹਾਂ ਬਾਣੀ ਪੜ੍ਹ ਕੇ